ਪੰਜਾਬ ਵਿੱਚ ਮੀਡੀਆ ਭਾਸ਼ਾ ਦੇ ਅਧਾਰ 'ਤੇ ਵਿਭਿੰਨਤਾ ਦਾ ਬਹੁਤ ਵੱਡਾ ਯੋਗਦਾਨ ਹੈ ਮੀਡੀਆ ਆਮ ਲੋਕਾਂ ਨੂੰ ਅੱਜ ਕੱਲ੍ਹ ਦੀ ਸੱਚਾਈ ਬਾਰੇ ਦੱਸਦੀ ਹੈ ਜਿਹੜੀ ਕਿ ਕਿਸੇ ਬੰਦੇ ਨੂੰ ਮਿੰਟਾਂ ਵਿੱਚ ਡਿਗਾ ਜਾਂ ਬਣਾ ਸਕਦੀ ਹੈ ਮੀਡੀਆ ਹਰੇਕ ਬੰਦੇ ਨੂੰ ਬੋਲਣ ਦਾ ਹੱਕ ਦਿੰਦੀ ਹੈ ਮੀਡੀਆ ਲੋਕਾਂ ਕੋਲ ਜਾ ਕੇ ਕਿਸੇ ਵੀ ਗੱਲ ਬਾਰੇ ਉਹਨਾਂ ਦੀ ਸਲਾਹ ਜਾਂ ਉਹਨਾਂ ਦਾ ਓਪੀਨੀਅਨ ਮੰਗਦੀ ਹੈ ਕਿ ਕੀ ਸ ਕੀ ਸੱਚ ਹੈ ਕੀ ਝੂਠ ਹੈ ਕਿ ਉਹਨਾਂ ਨੂੰ ਕਿਸੇ ਗੱਲ ਬਾਰੇ ਕੀ ਲੱਗਦਾ ਹੈ ਅਤੇ ਉਹਨਾਂ ਦੀ ਇਸ ਗੱਲ ਬਾਰੇ ਕੀ ਰਾਏ ਹੈ ਉਹਨਾਂ ਤੋਂ ਉਹਨਾਂ ਦੀ ਰਾਏ ਪੁੱਛਦੀ ਹੈ ਅਤੇ ਫਿਰ ਲੋਕਾਂ ਸਾਹਮਣੇ ਇਹ ਰੱਖਦੀ ਹੈ ਕਿ ਅੱਜ ਕੱਲ੍ਹ ਦੇ ਲੋਕ ਇਹ ਚਾਹੁੰਦੇ ਹਨ ਕੀ ਚੀਜ਼ ਉਹਨਾਂ ਨੂੰ ਸਹੀ ਲੱਗਦੀ ਹੈ ਅਤੇ ਉਹਨਾਂ ਨੂੰ ਕੀ ਲੱਗਦੀ ਹੈ ਅਤੇ ਉਹ ਇਸ ਗੱਲ ਬਾਰੇ ਆਵਾਜ਼ ਉਠਾਉਣਾ ਚਾਹੁੰਦੇ ਹਨ ਅਤੇ ਮੀਡੀਆ ਅਲੱਗ ਅਲੱਗ ਭਾਸ਼ਾ ਵਿੱਚ ਵੀ ਦਰਸਾਇਆ ਜਾਂਦਾ ਹੈ ਜਿਵੇਂ ਕਿ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿੱਚ ਮੀਡੀਆ ਆਪਣਾ ਪ੍ਰਚਾਰ ਕਰਦੀ ਹੈ ਲੋਕਾਂ ਦੇ ਹੱਕ ਵਿੱਚ ਕਿਤੇ ਬੋਲਦੀ ਹੈ ਮੀਡੀਆ ਵੀ ਲੋਕਾਂ ਨੂੰ ਲੋਕਾਂ ਲੋਕ ਆਪਦੀ ਭਲਾਈ ਲਈ ਇਹ ਚਾਹੁੰਦੇ ਹਨ ਅਤੇ ਉਹ ਉਹਨਾਂ ਦੇ ਵਿਕਾਸ ਲਈ ਲੋਕਾਂ ਦੇ ਵਿਕਾਸ ਲਈ ਇਹ ਜ਼ਿਆਦਾ ਜਰੂਰੀ ਹੈ